ਮੈਂ ਸੋਸ਼ਲ ਮੀਡੀਆ ਇੰਸਟਾਗਰਾਮ 'ਤੇ ਇੱਕ ਫੋਟੋਗ੍ਰਾਫਰ ਮੋਹਿਤ ਨੂੰ ਫੋਲੋ ਕਰਦਾ ਹਾਂ ਜਿਸ ਵਿੱਚ ਉਹ ਆਪਣਾ ਕੰਟੈਂਟ ਅਪਲੋਡ ਕਰਦਾ ਹੈ ਉਹ ਆਪਣੇ ਕੰਟੈਂਟ ਦੇ ਵਿੱਚ ਫੋਟੋਜ਼ ਵੀਡੀਓਜ਼ ਅਤੇ ਹੋਰ ਬਹੁਤ ਹੀ ਵਲੋਗਸ ਅਪਲੋਡ ਕਰਦਾ ਹੈ ਉਹ ਐਨੀਮਲਸ ਦੀ ਫੋਟੋ ਯਾਨੀ ਕਿ ਜਾਨਵਰਾਂ ਦੀਆਂ ਫੋਟੋਆਂ ਅਤੇ ਫਿਟਨੈਸ ਬ੍ਰੇਕ ਨੂੰ ਲੈ ਕੇ ਫਿਟਨੈਸ ਦੀ ਵੀਡੀਓਜ਼ ਪਾਉਂਦਾ ਹੈ ਅਤੇ ਨੇਚਰ ਦੀ ਫੋਟੋਜ਼ ਵੀ ਅਪਲੋਡ ਕਰਦਾ ਹੈ ਉਹਦੀ ਫੋਟੋਜ਼ ਬਹੁਤ ਹੀ ਅਟਰੈਕਟਿਵ ਹੁੰਦੀਆਂ ਹਨ ਉਹਦੇ ਇੰਸਟਾਗਰਾਮ ਚੈਨਲ ਉੱਤੇ ਪੰਜ ਮਿਲੀਅਨ ਫੋਲੋਵਰਸ ਹਨ ਉਹ ਆਪਣੇ ਯੂਥ ਨੂੰ ਇੰਕਰੇਜ ਕਰਦਾ ਹੈ ਕਿ ਤੁਸੀਂ ਫਿਟਨੈਸ ਵੱਲ ਧਿਆਨ ਦਿਓ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਹੈਗੇ ਹਨ ਉਹ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਅਤੇ ਆਦਮੀ ਵੀਡੀਓਜ਼ ਦੇ ਰਾਹੀਂ ਯੂਥ ਨੂੰ ਇਨਕਰੇਜ ਕਰਦਾ ਹੈ ਫੋਟੋ ਦੇ ਵਿੱਚ ਦੇਖਿਆ ਜਾ ਰਿਹਾ ਹੈ ਅੱਜ ਕੱਲ੍ਹ ਕਿ ਉਸ ਬੰਦੇ ਨੂੰ ਜਾਨਵਰਾਂ ਨਾਲ ਬਹੁਤ ਹੀ ਪ੍ਰੇਮ ਪਿਆਰ ਹੈ ਅਤੇ ਕੁਦਰਤ ਨਾਲ ਵੀ ਸਾਨੂੰ ਕੁਦਰਤ ਦੀ ਸੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਹਦੇ ਨਾਲ ਹੀ ਜਾਨਵਰਾਂ ਦੀ ਵੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਦੇ ਵਿੱਚ ਰੁੱਖ ਪਹਾੜ ਪਾਣੀ ਸਮੁੰਦਰ ਵਗੈਰਾ ਬਹੁਤ ਕੁਛ ਆ ਜਾਂਦਾ ਹੈ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਪਹਾੜ ਬਹੁਤ ਹੀ ਵਧੀਆ ਵਾਤਾਵਰਨ ਵਰਨ ਕ੍ਰੀਏਟ ਕਰਦੇ ਹਨ ਅਤੇ ਉਸ ਦੇ ਨਾਲ ਹੀ ਪਾਣੀ ਇੱਕ ਇਨਸਾਨ ਮਨੁੱਖੀ ਸਰੀਰ ਵਾਸਤੇ ਪਾਣੀ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਅਸੀਂ ਆਪਣਾ ਜੀਵਨ ਪਾਣੀ ਉੱਤੇ ਹੀ ਗੁਜ਼ਾਰਦੇ ਹਾਂ ਪਾਣੀ ਭੋਜਨ ਹਵਾ ਇਹ ਸਭ ਜਿਵੇਂ ਕਿ ਕਹਾਵਤਾਂ ਬਣੀਆਂ ਹੋਈਆਂ ਹਨ ਕਿ ਬੰਦੇ ਨੂੰ ਜ਼ਿੰਦਾ ਰਹਿਣ ਵਾਸਤੇ ਰੋਟੀ ਕੱਪੜਾ ਅਤੇ ਮਕਾਨ ਚਾਹੀਦਾ ਹੁੰਦਾ ਹੈ ਇਸ ਲਈ ਇਹ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ ਅੱਜ ਕੱਲ੍ਹ ਕਿ ਅਸੀਂ ਕੁਦਰਤ ਦੀ ਸਾਂਭ ਸੰਭਾਲ ਕਰੀਏ ਉਹਦਾ ਕੰਟੈਂਟ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਹੋਰ ਵੀ ਇੰਸਟਾਗਰਾਮ ਜਾਂ ਹੋਰ ਵੀ ਬਹੁਤ ਸੋਸ਼ਲ ਮੀਡੀਆ 'ਤੇ ਲਾਈਕ ਫੇਸਬੁਕ 'ਤੇ ਕ੍ਰੀਏਟਰ ਹਨ ਜੋ ਕਿ ਆਪਣੀ ਫੋਟੋਗ੍ਰਾਫੀ ਸਕਿਲ ਨੂੰ ਰੀਪ੍ਰਜੈਂਟ ਕਰਦੇ ਹਨ ਲੋਕਾਂ ਦੇ ਸਾਹਮਣੇ ਅਤੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੋਟੋਗ੍ਰਾਫਰਸ ਬਹੁਤ ਹੀ ਆ ਗਏ ਹਨ ਅਸੀਂ ਜਿਹਨੂੰ ਚਾਹੀਏ ਸਰਚ ਕਰਕੇ ਵੇਖ ਸਕਦੇ ਹਾਂ ਅਤੇ ਉਸ ਦਾ ਟੈਲੈਂਟ ਅਸੀਂ ਆਪਣੀਆਂ ਅੱਖਾਂ ਰਾਹੀ ਦੇਖ ਸਕਦੇ ਹਾਂ